ਬਰਤਨ ਧੋਣ ਦੀ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਜੂਠੇ ਭਾ ਭਾਂਡੇ ਹੁੰਦੇ ਆ ਉਹਨਾਂ ਨੂੰ ਸਾਫ਼ ਪਾਣੀ 'ਚੋਂ ਕੱਢ ਕੇ ਉਹਨਾਂ ਦੀ ਜੂਠ ਲਾਹ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਨੂੰ ਸਾਬਣ ਦੇ ਨਾਲ ਮਾਂਜਿਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਦੁਬਾਰਾ ਫਿਰ ਸਾਫ਼ ਪਾਣੀ ਦੇ ਵਿੱਚੋਂ ਕੱਢ ਕੇ ਅਤੇ ਫਿਰ ਆਪਣੇ ਬਰਤਨ ਸਾਫ਼ ਹੋ ਜਾਂਦੇ ਆ ਜ਼ਰੂਰੀ ਨਹੀਂ ਕਿ ਆਪਾਂ ਸਾਬਣ ਦੇ ਨਾਲ ਹੀ ਸਾਬਣ ਦੀ ਟਿੱਕੀ ਦੇ ਨਾਲ ਹੀ ਭਾਂਡਿਆਂ ਨੂੰ ਮਾਂਜਣਾ ਹੁਣ ਤਾਂ ਬਹੁਤ ਸਾਰੇ ਪ੍ਰੋਡਕਟ ਆ ਗਏ ਨੇ ਜਿਵੇਂ ਵਿੰਮ ਜੈੱਲ ਵਗੈਰਾ ਉਹਨਾਂ ਨਾਲ ਵੀ ਆਪਾਂ ਬਰਤਨ ਨੂੰ ਸਾਫ਼ ਕਰ ਸਕਦੇ ਹਾਂ ਅਤੇ ਠੰਡਾਂ ਦੇ ਵਿੱਚ ਹੁਣ ਪਾਣੀ ਦਾ ਵੀ ਫਰਕ ਪੈ ਜਾਂਦਾ ਕਿ ਠੰਡੇ ਪਾਣੀ ਦੇ ਨਾਲ ਆਪਣੇ ਜੋ ਮਤਲਬ ਧੰਦਿਆਈ ਜਿਹੜੀ ਆ ਭਾਂਡਿਆਂ ਦੇ ਉੱਪਰ ਉਹ ਨਹੀਂ ਉੱਤਰਦੀ ਇਸ ਲਈ ਆਪਾਂ ਨੂੰ ਕਈ ਵਾਰ ਤਾਂ ਆਪਾਂ ਗਰਮ ਪਾਣੀ ਵਰਤ ਲੈਂਦੇ ਹਾਂ ਤਾਂ ਜੋ ਥਿੰਦਾ ਜਿਹੜਾ ਉਹ ਚੰਗੀ ਤਰ੍ਹਾਂ ਉੱਤਰ ਜਾਵੇ ਅਤੇ ਭਾਂਡੇ ਆਪਣੇ ਕਾਫ਼ੀ ਸਾਫ਼ ਹੋਣ ਅੱਜ ਕੱਲ੍ਹ ਤਾਂ ਕਾਫ਼ੀ ਪ੍ਰੋਡਕਟ ਆ ਗਏ ਨੇ ਜਿਵੇਂ ਆਪਾਂ ਮਤਲਬ ਸਾਬਣ ਵਗੈਰਾ ਪਹਿਲਾਂ ਲੋਕ ਸਵਾਹ ਦੇ ਨਾਲ ਮਾਂਜਦੇ ਹੁੰਦੇ ਸੀਗੇ ਭਾਂਡੇ ਅਤੇ ਉਹ ਵੀ ਕਾਫ਼ੀ ਸਾਫ਼ ਨਿਖਰ ਕੇ ਬਾਹਰ ਨਿਕਲਦੇ ਸੀਗੇ ਸੋ ਆਪਾਂ ਭਾਂਡੇ ਤਾਂ ਬਸ ਇੱਦਾਂ ਹੀ ਹੈ ਕਿ ਪਹਿਲਾਂ ਜੂਠ ਕੱਢ ਲਓ ਫਿਰ ਉਹਨਾਂ ਨੂੰ ਸਾਬਣ ਲਗਾ ਕੇ ਫਿਰ ਦੁਬਾਰਾ ਉਹਨੂੰ ਸਾਫ਼ ਪਾਣੀ 'ਚੋਂ ਕੱਢ ਕੇ ਅਤੇ ਰੱਖ ਦਿਓ